ਬੈਂਕ ਦੇ ਵਿਚ ਕਸਟਮਰ ਦੀ ਸਰਵਿਸ ਦਾ ਬੈਂਕ ਵੱਲੋਂ ਪੂਰਾ ਧਿਆਨ ਰੱਖਿਆ ਜਾਂਦਾ ਹੈ ਮੈਂ ਤੁਹਾਨੂੰ ਇੱਕ ਇਗਜਾਮਪਲ ਦੇਣਾ ਚਾਹਵਾਂਗਾ ਕਿ ਮੈਂ ਹਾਲ ਹੀ ਦੇ ਵਿੱਚ ਆਪਣਾ ਇੱਕ ਡੈਬਿਟ ਕਾਰਡ ਅਪਲਾਈ ਕੀਤਾ ਸੀ ਕਰਨ ਜਾ ਰਿਹਾ ਸੀ ਅਤੇ ਉੱਥੇ ਮੈਨੂੰ ਬੈਂਕ ਵੱਲੋਂ ਜਾਂਦੇ ਹੀ ਕਾਫ਼ੀ ਉਹਨਾਂ ਨੇ ਅੱਛੀ ਤਰ੍ਹਾਂ ਡੀਲ ਕੀਤਾ ਔਰ ਮੈਨੂੰ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਅਗਰ ਦੇਖਿਆ ਜਾਵੇ ਤਾਂ ਵੀ ਉੱਥੇ ਹਰ ਕਿਸੇ ਨਾਲ ਹੀ ਉਹਨਾਂ ਦੀ ਡੀਲਿੰਗ ਬਹੁਤ ਵਧੀਆ ਰਹਿੰਦੀ ਹੈ ਕਿਸੇ ਵੀ ਬੈਂਕ ਦੇ ਕਸਟਮਰ ਨੂੰ ਉੱਥੇ ਜ਼ਿਆਦਾ ਵੇਟ ਨਹੀਂ ਕਰਨੀ ਪੈਂਦੀ ਔਰ ਉਹਨਾਂ ਦੇ ਬੋਲਣ ਦਾ ਤਰੀਕਾ ਵੀ ਬਹੁਤ ਵਧੀਆ ਲੱਗਦਾ ਔਰ ਕਿਸੇ ਦੀ ਵੀ ਪ੍ਰੋਬਲਮ ਨੂੰ ਜਿੰਨਾ ਜਲਦੀ ਹੋ ਸਕੇ ਉਹ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਨੇ ਮੇਰੇ ਡੈਬਿਟ ਕਾਰਡ ਨੂੰ ਅਪਲਾਈ ਕਰਨ ਦੇ ਵਿੱਚ ਵੀ ਕੋਈ ਜ਼ਿਆਦਾ ਸਮਾਂ ਨਹੀਂ ਲੱਗਿਆ ਹਾਰਡਲੀ ਤਿੰਨ ਔਰ ਚਾਰ ਮਿਨਟ ਦੇ ਵਿੱਚ ਮੇਰਾ ਕੰਮ ਉੱਥੇ ਹੋ ਗਿਆ ਸੀ ਔਰ ਮੇਰਾ ਉਹਨਾਂ ਨੇ ਡੈਬਿਟ ਕਾਰਡ ਅਪਲਾਈ ਕਰ ਦਿੱਤਾ ਸੀ